ਸਤਿ ਸ਼੍ਰੀ ਅਕਾਲ ਜੀ ਹਾਂਜੀ ਬੋਲੋ ਕੌਣ ਸੀ ਕਿਤਾ ਕਿਹੜੀ ਕਿਤਾਬ ਚਾਹੀਦੀ ਹੈ ਤੁਹਾਨੂੰ ਅੱਛਾ ਤੁਹਾਨੂੰ ਛੇਵੇਂ ਸਮੈਸਟਰ ਦੀ ਕਿਹੜੀਆਂ ਕਿਹੜੀਆਂ ਕਿਤਾਬਾਂ ਚਾਹੀਦੀਆਂ ਅੱਛਾ ਠੀਕ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਜਿਹੜੀ ਤੁਹਾਨੂੰ ਪਸੰਦ ਆਏਗੀ ਤੁਸੀਂ ਦੇਖ ਲੈਣਾ ਅਤੇ ਇੱਕ ਮਿੰਟ ਇਹ ਲਓ ਅਪਰੇਸ਼ਨਲ ਰਿਸਰਚ ਪੰਜਾਬੀ ਇੰਗਲਿਸ਼ ਫਾਈਨੈਂਸ਼ਅਲ ਰਿਸਰਚ ਅਤੇ ਇਹ ਪੋਰਟ ਫੋਲੀਓ ਇਹ ਤੁਸੀਂ ਇਕ ਵਾਰੀ ਦੇਖ ਲਓ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਮੈਂ ਤੁਹਾਨੂੰ ਇਹਦਾ ਰੇਟ ਦੱਸ ਦਿੰਨਾ ਹਾਂ ਹਾਂ ਮੈਂ ਤੁਹਾਨੂੰ ਦੇ ਦਿੰਦੀ ਹਾਂ ਦੂਜੀ ਵੀ ਪਈ ਆ ਸਾਡੇ ਕੋਲ ਹੋਰ ਵੀ ਨੇ ਇਹ ਲਓ ਇਹ ਵਾਲੀ ਲੈ ਲਓ ਇਹ ਦੋ ਹਜ਼ਾਰ ਇੱਕੀ ਦੀ ਹੈ ਹਜੇ ਹਾਂਜੀ ਇੰਗਲਿਸ਼ ਵਾਲੀ ਜਿਹੜੀ ਤੁਹਾਡੀ ਹੈਗੀ ਆ ਉਹ ਡੇਢ ਸੌ ਦੀ ਆ ਪੰਜਾਬੀ ਤੁਹਾਡੀ ਡੇਢ ਸੌ ਦੀ ਆ ਫਾਈਨੈਂਸ਼ੀਅਲ ਸਰਵਿਸ ਡੇਢ ਸੌ ਦੀ ਆ ਆਪਰੇਸ਼ਨਲ ਰਿਸਰਚ ਸਾਢੇ ਤਿੰਨ ਸੌ ਅਤੇ ਪੋਰਟ ਫੋਲੀਓ ਡੇਢ ਸੌ ਅਤੇ ਇਹ ਕੋਪਰੇਟ ਗਵਰਨਸ ਦੋ ਸੌ ਅਤੇ ਟੋਟਲ ਤੁਹਾਡਾ ਹੋ ਗਿਆ ਗਿਆਰਾਂ ਸੌ ਪੰਜਾਹ ਹਾਂਜੀ ਇਹ ਸੈਕਿੰਡ ਹੈਂਡ ਹੀ ਨੇ ਨਵੀਆਂ ਤਾਂ ਇਸ ਤੋਂ ਵੀ ਵੱਧ ਰੇਟ ਹੈ ਚੱਲੋ ਤੁਸੀਂ ਪੰਜਾਹ ਰੁਪਏ ਘੱਟ ਦੇ ਦਿਓ ਚੱਲੋ ਹੋਰ ਹੋਰ ਅਸੀਂ ਤੁਹਾਨੂੰ ਇਹ ਲਓ ਤੁਸੀਂ ਵੀਹ ਰੁਪਏ ਇਹਦੇ ਘੱਟ ਦੇ ਦੇਣਾ ਇੱਕ ਸੌ ਤੀਹ ਦੇ ਦਿਓ ਆਪਰੇਸ਼ਨਲ ਰਿਸਰਚ ਦੇ ਵੀ ਵੀਹ ਘੱਟ ਦੇ ਦਿਓ ਸਾਢੇ ਤਿੰਨ ਤਿੰਨ ਸੌ ਸੀਗੇ ਤੁਸੀਂ ਇਹਦੇ ਤਿੰਨ ਸੌ ਤੀਹ ਦੇ ਦਿਓ ਪੋਰਟ ਫੋਲੀਓ ਦੇ ਇੱਕ ਸੌ ਤੀਹ ਅਤੇ ਇਹਦੇ ਨਾ ਨਾ ਮੈਡਮ ਜੀ ਇਹਦੇ ਇੱਕ ਸੌ ਤੀਹ ਹੋਣਗੇ ਉਹ ਤਿੰਨ ਸੌ ਤੀਹ ਹੋਣੇ ਜੇ ਇਹਦੇ ਅਤੇ ਇਸ ਤੋਂ ਜ਼ਿਆਦਾ ਨਹੀਂ ਅਸੀਂ ਕਰ ਸਕਦੇ ਹੁਣ ਹੁਣ ਤੁਸੀਂ ਟੋਟਲ ਜੀ ਤੁਸੀਂ ਟੋਟਲ ਦੇ ਦਿਓ ਅੱਠ ਸੌ ਪਚਵੰਜਾ ਦੇ ਦਿਓ ਹਾਂਜੀ

ਦੇ ਦਿਓ ਅਤੇ ਦੇਖ ਲਓ ਠੀਕ ਹੈ